ਜਿਵੇਂ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਦਸਵੀਂ ਦੇ ਵਿੱਚ ਮੈਨੂੰ ਇਹ ਚੀਜ਼ਾਂ ਦੀ ਨੌਲੇਜ ਹੋਈ ਸੀ ਉਦੋਂ ਪਤਾ ਲੱਗਿਆ ਸੀ ਕਿ ਟੁੱਟ ਦੇ ਤਾਰੇ ਨੂੰ ਕੀ ਕਿਵੇਂ ਕੀ ਕਿਹਾ ਜਾਂਦਾ ਅਤੇ ਮੈਂ ਉਦੋਂ ਉਸ ਟਾਈਮ ਦੇ ਵਿੱਚ ਮਤਲਬ ਵਿਸ਼ ਮੰਗੀ ਸੀ ਜਿਵੇਂ ਕਿ ਬਾਕੀ ਬੱਚੇ ਵਿਸ਼ ਮੰਗਦੇ ਨੇ ਅਤੇ ਉਦੋਂ ਮੈਂ ਉਸ ਤੋਂ ਵਿਸ਼ ਮੰਗੀ ਸੀ ਕਿ ਮੇਰੇ ਟੈਂਥ ਦੇ ਵਿੱਚ ਵਧੀਆ ਨੰਬਰ ਆ ਜਾਣ ਤਾਂ ਮੇਰਾ ਜਿਹੜਾ ਸ਼ੂਟਿੰਗ ਸਟਾਰ ਆ ਜਾਂ ਆਪਾਂ ਟੁੱਟਦੇ ਹੋਏ ਤਾਰਿਆਂ ਨੂੰ ਦੇਖਣਾ ਇਹ ਐਕਸਪੀਰੀਅੰਸ ਹੁਣ ਵੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ